ਬਿਜਲੀ ਤੋਂ ਬਹੁਤ ਸਾਰੇ ਖਤਰੇ ਹਨ ਜਿਵੇਂ ਕਿ ਇੱਕ ਤਾਂ ਘਰ ਦੇ ਵਿੱਚ ਸ਼ੋਟ ਸਰਕਿਟ ਹੋਣ ਦਾ ਬਹੁਤ ਵੱਡਾ ਖ਼ਤਰਾ ਹੁੰਦਾ ਹੈ ਦੂਸਰਾ ਅਸੀਂ ਆਪਣੇ ਬੱਚਿਆਂ ਤੋਂ ਇਹਨੂੰ ਬਚਾਉਣਾ ਚਾਹੀਦਾ ਹੈ ਬੱਚੇ ਇਸ ਦੇ ਨਾਲ ਲੱਗ ਕੇ ਮੌਤ ਦਾ ਕਾਰਨ ਵੀ ਹੋ ਸਕਦਾ ਹੈ ਇ ਇਸ ਕਰਕੇ ਬਿਜਲੀ ਤੋਂ ਬਚਣਾ ਬਹੁਤ ਜ਼ਰੂਰੀ ਹੈ ਬਿਜਲੀ ਕਈ ਪ੍ਰਕਾਰ ਦੀ ਹੈ ਬਿਜਲੀ ਜਿਵੇਂ ਕਿ ਕਾਫ਼ੀ ਵੱਡ ਤੇਜ਼ ਬਿਜਲੀ ਆਉਣ ਨਾਲ ਘਰ ਦੇ ਜਿਹੜੇ ਹੈਗੇ ਸਮਾਨ ਜਿਸ ਤਰ੍ਹਾਂ ਕਿ ਗੀਜਰ ਕੂਲਰ ਏ ਸੀ ਫ੍ਰਿਜ ਟੀ ਵੀ ਵਾਸ਼ਿੰਗ ਮਸ਼ੀਨਾਂ ਕਿਸੇ ਵੀ ਪ੍ਰਕਾਰ ਦਾ ਬਿਜਲੀ ਦਾ ਸਮਾਨ ਸੜ ਜਾਂਦਾ ਹੈ ਇਸ ਕਰਕੇ ਬਿਜਲੀ ਦੇ ਜਿਹੜੇ ਆਪਣੇ ਹੈਗੇ ਆ ਉਹ ਉਹਨਾਂ ਦੀ ਵਰਤੋਂ ਸਹੀ ਤਰ੍ਹਾਂ ਕਰਨੀ ਚਾਹੀਦੀ ਹੈ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਬਿਜਲੀ ਤੋਂ ਬੱਚਿਆਂ ਨੂੰ ਬਚਾਉਣ ਦੀ ਜ਼ਰੂਰਤ ਤਾਂ ਕਿ ਅਸੀਂ ਹੋਰ ਕਿਸੇ ਪ੍ਰਕਾਰ ਦਾ ਦੁੱਖ ਨਾਲ ਲੈ ਸਕੀਏ ਇਸ ਲਈ ਸਾਨੂੰ ਆਪਣਾ ਕੰਮ ਧਿਆਨ ਨਾਲ ਕਰਨਾ ਚਾਹੀਦਾ ਹੈ ਦੂਸਰਾ ਇਸ ਦੇ ਜਿਹੜੇ ਕਾਰਨ ਤੋਂ ਬਚਣ ਲਈ ਸਾਨੂੰ ਜਿਹੜੀ ਹੈਗੀ ਆ ਬਿਜਲੀ ਦੀਆਂ ਤਾਰਾਂ ਸਹੀ ਤਰ੍ਹਾਂ ਦੀ ਚੋਇਸ ਕਰਨੀ ਚਾਹੀਦੀ ਹੈ ਜਿਵੇਂ ਕਿ ਚੰਗੀ ਕੰਪਨੀਆਂ ਦੇ ਤਾਰ ਪਾਓ ਆਪਣੇ ਐੱਮ ਸੀ ਬੀ ਜਿਹੜੇ ਸਵਿੱਚ ਹੈ ਚੰਗੇ ਲਵਾਓ ਜਿਸ ਨਾਲ ਕੀ ਘਰ ਦੇ ਵਿੱਚ ਸ਼ੋਟ ਸਰਕਿਟ ਦਾ ਖ਼ਤਰਾ ਬਹੁਤ ਘੱਟ ਜਾਵੇ ਜਿਸ ਕਾਰਨ ਅਸੀਂ ਆਪਣਾ ਬਚਾਅ ਕਰ ਸਕੀਏ ਆਪਣਾ ਰੈਗੂਲਰ ਚੈੱਕ ਬਿਜਲੀ ਦਾ ਚੈੱਕ ਕਰਾਉਂਦੇ ਰਹੋ ਤਾਂ ਕਿ ਦੂਸਰਾ ਕੰਮ ਨਾ